ਮੇਰੀ ਜ਼ਿੰਦਗੀ ਵਿੱਚ ਬਹੁਤ ਹੀ ਸਾਰੇ ਪਰਾਊਡ ਮੂਮੈਂਟ ਹੈ ਮੈਂ ਅੱਜ ਇੱਕ ਪਰਾਊਡ ਮਤਲਬ ਇੱਕ ਬਹੁਤ ਹੀ ਵਧੀਆ ਪਰਾ ਪਰਾਊਂਡ ਮੂਮੈਂਟ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਮੈਂ ਅੱਜ ਤੋਂ ਦੋ ਸਾਲ ਪਹਿਲਾਂ ਮਤਲਬ ਪਲੱਸ ਟੂ ਕਰਦੀ ਸੀ ਅਤੇ ਫਿਰ ਮੈਂ ਮਤਲਬ ਬਿਮਾਰ ਹੋ ਗਈ ਸੀ ਦੋ ਮਹੀਨੇ ਬਿਮਾਰ ਹੋ ਗਈ ਸੀ ਅਤੇ ਫਿਰ ਮੈਂ ਮਤਲਬ ਪੜ੍ਹਨ 'ਚ ਵੀ ਜੀਅ ਨਹੀਂ ਲੱਗਦਾ ਸੀ ਫਿਰ ਮਤਲਬ ਜਦ ਮੈਂ ਠੀਕ ਹੋਈ ਤਾਂ ਮੈਂ ਫਿਰ ਮੈਂ ਮਤਲਬ ਪੜ੍ਹਨ 'ਚ ਜੀਅ ਲਗਾਇਆ ਅਤੇ ਮਤਲਬ ਮੈਂ ਬਿਮਾਰ ਦੇ ਸਮੇਂ ਮੈਨੂੰ ਪੜ੍ਹਨ ਦਾ ਜੀਅ ਨਹੀਂ ਕਰਦਾ ਸੀ ਮੈਨੂੰ ਟੈਨਸ਼ਨ ਹੋ ਜਾਂਦੀ ਸੀ ਮੈਂ ਪੇਪਰ ਕਿਵੇਂ ਦੇ ਫਿਰ ਜਦ ਮਤਲਬ ਮੈਂ ਪੜ੍ਹਨ ਲੱਗੀ ਅਤੇ ਫਿਰ ਮੈਂ ਜਦ ਮੇਰਾ ਰਿਜ਼ਲਟ ਆ ਗਿਆ ਇੰਗਜ਼ਾਮ ਹੋ ਗਏ ਫਿਰ ਉਸ ਕੇ ਬਾਅਦ ਰਿਜ਼ਲਟ ਆ ਗਿਆ ਫਿਰ ਮੈਂ ਦੇਖਿਆ ਕਿ ਮੇਰੇ ਨਾਈਟੀ ਫਾਈਵ ਪ੍ਰਸੈਂਟ ਆ ਗਏ ਅਤੇ ਮੈਂ ਬਹੁਤ ਖੁਸ਼ ਹੋਈ ਫਿਰ ਮੇਰੇ ਘਰ ਦੇ ਵੀ ਬਹੁਤ ਖੁਸ਼ ਹੋਏ ਸੀ ਅਤੇ ਮੇਰੀ ਮਤਲਬ ਮੇਰੇ ਘਰਦਿਆਂ ਨੂੰ ਬੁਲਾ ਕੇ ਮਤਲਬ ਉੱਥੇ ਫੋਟੋ ਵਗੈਰਾ ਖਿੱਚੀ ਅਤੇ ਮੈਨੂੰ ਟਰੋਫੀ ਵਗੈਰਾ ਦਿੱਤੇ ਗਏ ਅਤੇ ਮੈਨੂੰ ਐਜ਼ੂਕੇਸ਼ਨ ਵੀ ਫ਼ਰੀ ਦਿੱਤੀ ਇੱਕ ਸਾਲ ਦੀ ਮਤਲਬ ਮ ਮਤਲਬ ਅੱਛੇ ਪ੍ਰਸੈਂਟੇਜ ਮਤਲਬ ਉੱਥੇ ਸੀਗੇ ਅਤੇ ਫਿਰ ਮਤਲਬ ਮੈਨੂੰ ਜਿਹੜੀ ਟਰੋਫੀ ਦਿੱਤੀ ਗਈ ਹੈ ਮੈਂ ਉਹ ਸਾਂਭ ਕੇ ਰੱਖੀ ਆ ਅਤੇ ਫੋੋਟੋ ਵਗੈਰਾ ਵੀ ਸਾਂਭ ਕੇ ਰੱਖੀ ਆ ਅਤੇ ਮੈਂ ਹੁਣ ਨਰਸਿੰਗ ਕਰਨ ਲੱਗੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮਤਲਬ ਮੈਂ ਮਤਲਬ ਵਧੀਆ ਮਤਲਬ ਪੜ੍ਹਾਂ ਮਤਲਬ ਹਾਰਡ ਵਰਕਿੰਗ ਕਰਾਂ ਕਿਉਂਕਿ ਮੇਰੇ ਪੇਰੈਂਟਸ ਇੰਨੇ ਐਫਰਟਸ ਕਰ ਰਹੇ ਹੈ ਅਤੇ ਮਤਲਬ ਮਤਲਬ ਮਤਲਬ ਨਾਮ ਹੋਵੇ ਮਤਲਬ ਵਧੀਆ ਅਤੇ ਮਤਲਬ ਮੈਂ ਮੇਰੇ ਪੇਰੈਂਟਸ ਵੀ ਇਹ ਚਾਹੁੰਦੇ ਹੈ ਕਿ ਮਤਲਬ ਵਧ ਮਤਲਬ ਪੜ੍ਹ ਲਿਖ ਜਾਵਾਂ ਅਤੇ ਵਧੀਆ ਮਤਲਬ ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਵਾਂ ਅਤੇ ਮੈਂ ਚਾਹੁੰਦੀ ਹਾਂ ਕਿ ਮਤਲਬ ਮਤਲਬ ਅੱਛੀ ਮਤਲਬ ਇਹ ਜਿਹੜੀ ਨਰਸਿੰਗ ਹੁੰਦੀ ਹੈ ਮਤਲਬ ਹੁੰਦੀ ਹੈ ਕਿ ਮਤਲਬ ਕਿਤੇ ਵੀ ਮਤਲਬ ਜੌਬ ਕਰ ਸਕਦੇ ਹੈ ਮਤਲਬ ਅਸਾਨੀ ਨਾਲ ਜੌਬ ਮਿਲ ਸਕਦਾ ਅਤੇ ਮੈਂ ਮੈਂ ਚਾਹੁੰਦੀ ਹਾਂ ਕਿ ਮੈਂ ਇੱਦਾਂ ਹੀ ਮਿਹਨਤ ਕਰਦੀ ਰਹਾਂ ਮੈਂ ਹਾਰਡ ਵਰਕਿੰਗ ਹੋਵਾਂ